ਸ਼ੱਸ਼ੀਕਾਲ ਮੇਰਾ ਨਾਮ ਪ੍ਰਭਜੋਤ ਕੌਰ ਹੈ ਕੀ ਮੈਂ ਮਨਜੋਤ ਟਰੈਵਲਜ਼ ਨਾਲ ਗੱਲ ਕਰ ਰਹੀ ਹਾਂ ਮੈਂ ਤੁਹਾਡੀ ਗੱਡੀ ਥੋੜ੍ਹੇ ਦਿਨਾਂ ਲਈ ਕਿਰਾਏ 'ਤੇ ਲੈਣਾ ਚਾਹੁੰਦੀ ਹਾਂ ਕਿਉਂਕਿ ਮੈਂ ਆਪਣੇ ਪਰਿਵਾਰ ਨਾਲ ਬਾਬਾ ਬਾਲਕ ਨਾਥ ਜਾਣ ਜੀ ਦਾ ਪਲੈਨ ਬਣਾਇਆ ਹੈ ਆਪਣਾ ਨਵਾਂ ਸਾਲ ਮਨਾਉਣ ਲਈ ਤਾਂ ਕਰਕੇ ਮੈਂ ਤੁਹਾਡੀ ਗੱਡੀ ਨੂੰ ਕੁਛ ਦਿਨਾਂ ਲਈ ਕਿਰਾਏ 'ਤੇ ਲੈਣਾ ਚਾਹੁੰਦੀ ਹਾਂ ਮੈਂ ਮੈਨੂੰ ਇਹ ਗੱਡੀ ਕੁਝ ਦਿਨਾਂ ਲਈ ਕਿਰਾਏ 'ਤੇ ਦਿੱਤੀ ਜਾਵੇ ਮੇਰੇ ਕੋਲ ਆਪਣਾ ਲਾਇਸੈਂਸ ਹੈ ਅਤੇ ਮੈਨੂੰ ਗੱ ਟਰੈਫਿਕ ਰੂਲਸ ਬਾਰੇ ਵੀ ਕਾਫੀ ਪਤਾ ਹੈ ਤਾਂ ਕਰਕੇ ਇਹ ਯਾਤਰਾ ਪਟਿਆਲੇ ਤੋਂ ਬਾਬਾ ਬਾਲਕ ਨਾਥ ਜਾਣ ਦੀ ਚਾਰ ਸੋ ਕਿਲੋਮੀਟਰ ਤੱਕ ਦੀ ਹੋਵੇਗੀ ਮੈਂ ਤੁਹਾਡੀ ਬਹੁਤ ਧੰਨਵਾਦ ਹੋਵਾਂਗੀ ਜਿੰਨਾ ਵੀ ਪੈਸਾ ਤੁਹਾਡਾ ਬਣੇਗਾ ਮੈਂ ਤੁਹਾਨੂੰ ਕੈਸ਼ ਜਾਂ ਔਨਲਾਈਨ ਪੇਮੈਂਟ ਕਰ ਦੇਵਾਂਗੀ ਧੰਨਵਾਦ